ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਰਜਿੰਦਰ ਸਿੰਘ ਜੀ ਗੱਲ ਕਰ ਰਹੇ ਹੋ ਹਾਂਜੀ ਭਾਅ ਜੀ ਆਪਣੀ ਅ ਅੰਮ੍ਰਿਤ ਟਰੈਵਲ ਏਜੰਸੀ ਤੋਂ ਨਾ ਜੀ ਹਾਂਜੀ ਭਾਅ ਜੀ ਮੈਂ ਨਾ ਤੁਹਾਡੀ ਅ ਕੈਬ ਬੁੱਕ ਕੀਤੀ ਸੀਗੀ ਅੱਜ ਦੇ ਦਿਨ ਵਾਸਤੇ ਚਾਰ ਦਿਨ ਦਾ ਟ੍ਰਿਪ ਸੀ ਆਪਣਾ ਡਲਹੌਜੀ ਜਾਣ ਦਾ ਅਤੇ ਭਾਅ ਜੀ ਅਸੀਂ ਤੁਹਾਨੂੰ ਦਿੱਤਾ ਸੀ ਟਾਈਮ ਸਵੇਰੇ ਨੌਂ ਵਜੇ ਦਾ ਅਤੇ ਤੁਸੀਂ ਹੁਣ ਦੇਖੋ ਸਾਢੇ ਨੌਂ ਦਸ ਵੱਜ ਚੱਲੇ ਆ ਅਤੇ ਤੁਸੀਂ ਹਜੇ ਤੱਕ ਆਏ ਨਹੀਂ ਹੋ ਅਤੇ ਕਿਉਂਕਿ ਦੇਖੋ ਅ ਆਪਣਾ ਸਫ਼ਰ ਕਾਫੀ ਲੰਬਾ ਆਪਾਂ ਨੂੰ ਫਿਰ ਜਾਂਦੇ ਹੋਏ ਛੇ ਤੋਂ ਸੱਤ ਘੰਟੇ ਲੱਗ ਜਾਣੇ ਹੈ ਅਤੇ ਦੂਸਰੀ ਗੱਲ ਤੁਹਾਨੂੰ ਪਤਾ ਹੈ ਜੂਨ ਦਾ ਮਹੀਨਾ ਚੱਲ ਰਿਹਾ ਛੁੱਟੀਆਂ ਚੱਲ ਰਹੀਆਂ ਅਤੇ ਉੱਥੇ ਟਰੈਫਿਕ ਬਹੁਤ ਜ਼ਿਆਦਾ ਹੈ ਅਤੇ ਜਿਹਦੇ ਕਰਕੇ ਆਪਾਂ ਬਹੁਤ ਜ਼ਿਆਦਾ ਲੇਟ ਹੋ ਜਾਣਾ ਹੈ ਅਤੇ ਤੁਸੀਂ ਬਹੁਤ ਲੇਟ ਹੋ ਗਏ ਹੋ ਅਤੇ ਮੈਨੂੰ ਦੱਸੋ ਤੁਸੀਂ ਇਸ ਟਾਈਮ ਕਿੱਥੇ ਪਹੁੰਚੇ ਹੋ ਅਤੇ ਤੁਹਾਡੀ ਲੋਕੇਸ਼ਨ ਕੀ ਹੈ ਅਤੇ ਤੁਸੀਂ ਉੱਥੇ ਮੇਰੇ ਤੱਕ ਕਦੋਂ ਪਹੁੰਚ ਜਾਓਗੇ ਕਿਉਂਕਿ ਤੁਹਾਨੂੰ ਪਤਾ ਹੈ ਗਰਮੀ ਬਹੁਤ ਜ਼ਿਆਦਾ ਹੈ ਅਤੇ ਬੱਚੇ ਤੁਹਾਨੂੰ ਪਤਾ ਛੁੱਟੀਆਂ ਕਰਕੇ ਘੁੰਮਣ ਨੂੰ ਕਾਹਲੇ ਪਏ ਹੋਏ ਹੈ ਕਿਉਂਕਿ ਉਹ ਪਿਛਲੇ ਪੰਦਰਾਂ ਵੀਹ ਦਿਨਾਂ ਤੋਂ ਘਰ ਹੀ ਬੈਠੇ ਹੋਏ ਨੇ ਅਤੇ ਉਹ ਵੀ ਹੁਣ ਬੋਰ ਹੋ ਗਏ ਨੇ ਅਤੇ ਤੁਸੀਂ ਹੋ ਸਕੇ ਤਾਂ ਜਲਦੀ ਤੋਂ ਜਲਦੀ ਮੈਨੂੰ ਦੱਸੋ ਤੁਸੀਂ ਕਿੱਥੇ ਖੜ੍ਹੇ ਹੋ ਕਿਉਂਕਿ ਅਸੀਂ ਤੁਹਾਡਾ ਵੇਟ ਆਪਣੇ ਘਰ ਦੇ ਬਾਹਰ ਖੜ੍ਹੇ ਹੋ ਕੇ ਕਰ ਰਹੇ ਹਾਂ ਸਾਡਾ ਬੈਗ ਵਗੈਰਾ ਸਭ ਕੁਛ ਪੈਕ ਹੋ ਚੁੱਕਾ ਅਤੇ ਹੋ ਸਕਦਾ ਕਿ ਤੁਸੀਂ ਅਸੀਂ ਜਿੰਨੀ ਜਲਦੀ ਹੋ ਸਕੇ ਅਸੀਂ ਉੱਥੇ ਪਹੁੰਚੀਏ ਅਤੇ ਆਪਣਾ ਟਾਈਮ ਸੇਵ ਕਰਕੇ ਉੱਥੇ ਜਾ ਕੇ ਬੱਚੇ ਵਗੈਰਾ ਆਪਣੇ ਰੈਸਟ ਵੀ ਕਰ ਸਕਣ ਕਿਉਂਕਿ ਮੈਨੂੰ ਪਤਾ ਲੱਗਾ ਕਿ ਉੱਥੇ ਟਰੈਫਿਕ ਬਹੁਤ ਜ਼ਿਆਦਾ ਅਤੇ ਚਾਰ ਚਾਰ ਤੋਂ ਪੰਜ ਘੰਟੇ ਦਾ ਉੱਥੇ ਜਾਮ ਚੱਲ ਰਿਹਾ ਹੈ ਅਤੇ ਜਿਹਦੇ ਕਰਕੇ ਅਗਰ ਆਪਾਂ ਹੁਣ ਨਿਕਲਾਂਗੇ ਅਤੇ ਅਗਰ ਆਪਾਂ ਚਾਰ ਪੰਜ ਘੰਟੇ ਰਸਤਾ ਹੈ ਅਤੇ ਅਗਰ ਉਹ ਅੱਗੇ ਜਾਮ ਹੋਇਆ ਜਾਂ ਕੋਈ ਅੱਗੇ ਕੋਈ ਪ੍ਰੋਬਲਮ ਹੋਈ ਤਾਂ ਆਪਾਂ ਨੂੰ ਤਾਂ ਪਹੁੰਚਦੇ ਪਹੁੰਚਦੇ ਰਾਤ ਦਸ ਵੱਜ ਜਾਣੇ ਆ ਜਿਹਦੇ ਕਰਕੇ ਆਪਾਂ ਕਾਫੀ ਲੇਟ ਹੋ ਜਾਣਾ ਅਤੇ ਆਪਣਾ ਜਿਹੜਾ ਅੱਗੇ ਆਪਣੇ ਹੋਟਲ ਵਗੈਰਾ ਬੁੱਕ ਕੀਤੇ ਹੋਏ ਜਾਂ ਆਪਾਂ ਉਸ ਤੋਂ ਅੱਗੇ ਦਾ ਘੁੰਮਣ ਜਾਣਾ ਅਤੇ ਆਪਾਂ ਉੱਥੇ ਵੀ ਕਾਫੀ ਲੇਟ ਹੋ ਜਾਣਾ ਆਪਾਂ ਡਲਹੌਜ਼ੀ ਹੋ ਕੇ ਆਪਾਂ ਨੇ ਜਾਣਾ ਤੁਹਾਨੂੰ ਦੱਸਿਆ ਸੀ ਆਪਾਂ ਜਾਣਾ ਹੈ ਅਤੇ ਮੈਨੂੰ ਉਮੀਦ ਹੈ ਤੁਸੀਂ ਜਲਦੀ ਤੋਂ ਜਲਦੀ ਦੱਸੋ ਤੁਸੀਂ ਕਿੱਥੇ ਖੜ੍ਹੇ ਹੋ ਅਤੇ ਤੁਹਾਡੀ ਲੋਕੇਸ਼ਨ ਕੀ ਹੈ ਅਤੇ ਕਿੰਨਾ ਟਾਈਮ ਲੱਗੇਗਾ ਤੁਹਾਨੂੰ ਆਉਣ ਨੂੰ ਧੰਨਵਾਦ ਜੀ